ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਤੁਸੀਂ ਗਿੱਦੜਵਾ ਤੋਂ ਬੋਲ ਰਹੇ ਹੋ ਕਰਨ ਵੈਜੀਟੇਬਲ ਵਾਲੇ ਅੱਛਾ ਠੀਕ ਹੈ ਜੀ ਅਸੀਂ ਨਾ ਗਿਦ ਝੁੰਬੇ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਜਾਣਦੇ ਹੋਊਗੇ ਅਸੀਂ ਤੁਹਾਡੇ ਕੋਲੋਂ ਅੱਗੇ ਵੀ ਫੋਨ ਫੂਨ ਕਰਕੇ ਔਡਰ ਉਡਰ ਪਾਉਂਦੇ ਹੀ ਰਹਿੰਦੇ ਵੈਜੀਟੇਬਲ ਤੁਹਾਡੇ ਤੋਂ ਹੀ ਮੰਗਵਾਉਂਦੇ ਹਾਂ ਨਾ ਯਾਦ ਹੈ ਜੀ ਤੁਹਾਨੂੰ ਹਾਂਜੀ ਹਾਂਜੀ ਸੈਕਟਰੀ ਕੇ ਘਰੋਂ ਜੀ ਹਾਂਜੀ ਹਾਂਜੀ ਹੋਰ ਠੀਕ ਹੋ ਜੀ ਠੀਕ ਹੈ ਜੀ ਉਹ ਇੰਝ ਸੀ ਜੀ ਆਪਣੇ ਬੇਟੇ ਦੀ ਬਰਥਡੇ ਪਾਰਟੀ ਰੱਖੀ ਸੀ ਜੀ ਘਰ ਅਤੇ ਸਾਡੇ ਰਿਲੇਟਿਵ ਨੇ ਆਉਣਾ ਸੀਗਾ ਕਈ ਜਣਿਆਂ ਨੇ ਪੰਜਾਹ ਕੁ ਜਣੇ ਹੋ ਜਾਣਗੇ ਅਤੇ ਵੀ ਸਬਜ਼ੀਆਂ ਦਾ ਔਡਰ ਪਾਉਣਾ ਸੀਗਾ ਜੀ ਤੁਹਾਡੇ ਕੋਲ ਨੋਟ ਕਰੋਗੇ ਜੀ ਔਡਰ ਅੱਛਾ ਜੀ ਐਂ ਦੱਸਿਓ ਜੀ ਮੈਨੂੰ ਵੀ ਆਪਾਂ ਵੀ ਪੰਜਾਹ ਜਣਿਆ ਵਾਸਤੇ ਸਬਜ਼ੀ ਤਿਆਰ ਕਰਨੀ ਆ ਵੀ ਇੱਕ ਤਾਂ ਸਾਨੂੰ ਫਿਰੋਜਨ ਮਟਰ ਭੇਜ ਦਿਓ ਜੀ ਪੰਜ ਕਿਲੋ ਬਹੁਤ ਹੋਣਗੇ ਜੀ ਪੰਜ ਕਿਲੋ ਕੇ ਦੱਸ ਕਿਲੋ ਲਈਏ ਜੀ ਅੱਛਾ ਜੀ ਅਤੇ ਪਨੀਰ ਪੰਜਾਹ ਜਣੇ ਹੈ ਜੀ ਠੀਕ ਹੈ ਜੀ ਪੰਜ ਕਿਲੋ ਫਿਰ ਫਰੋਜਨ ਮਟਰ ਪਾ ਦਿਓ ਜੀ ਅਤੇ ਫਿਰ ਪਨੀਰ ਕਿੰਨਾ ਪਾਈਏ ਜੀ ਚਾਰ ਤਿੰਨ ਕਿਲੋ ਕੇ ਚਾਰ ਜੀ ਠੀਕ ਹੈ ਜੀ ਫਿਰ ਤਿੰਨ ਕਿਲੋ ਪਨੀਰ ਲਿਖ ਲਓ ਜੀ ਪੰਜ ਕਿਲੋ ਮਟਰ ਲਿਖ ਲਓ ਜੀ ਅਤੇ ਨਾਲ ਜੀ ਦੱਸੋ ਹੁਣ ਵੈਜੀਟੇਬਲ ਜਿਹੜੀਆਂ ਫਰੋਜਨ ਸਾਨੂੰ ਮਿਕਸ ਵੈਜੀਟੇਬਲ ਮਿਲਜੂਗੀ ਜੀ ਪੈਕਿੰਗ ਹਾਂਜੀ ਉਹ ਦੇ ਦਿਓ ਜੀ ਇੱਕ ਸੁੱਕੀ ਵੀ ਸਬਜ਼ੀ ਬਣਾਉਣੀ ਹੈ ਨਾ ਕਿੰਨੀ ਤਿੰਨ ਕਿਲੋ ਪਾ ਦਿਓ ਜੀ ਫਿਰ ਸੁੱਕੀ ਵੈੱਜ ਬਹੁਤ ਹੋਊ ਜੀ ਤਿੰਨ ਕਿਲੋ ਠੀਕ ਹੈ ਜੀ ਅਤੇ ਤਿੰਨ ਕਿਲੋ ਆਲੂ ਪਾ ਦਿਓ ਜੀ ਅਤੇ ਸਲਾਦ ਜੀ ਖੀਰੇ ਅਤੇ ਟਮਾਟਰ ਨਿੰਬੂ ਅਤੇ ਬੰਦ ਗੋਭੀ ਅਤੇ ਚੁਕੰਦਰ ਠੀਕ ਹੈ ਜੀ ਇਹ ਸਲਾਦ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਵੀ ਤੁਹਾਨੂੰ ਵੀ ਪਤਾ ਹੀ ਹੈ ਵੀ ਪੰਜਾਹ ਬੰਦਿਆਂ ਵਾਸਤੇ ਵੀ ਕਿੰਨਾ ਕੁ ਜ਼ਰੂਰਤ ਹੋਊਗੀ ਦੋ ਢਾਈ ਕਿਲੋ ਖੀਰੇ ਹੋ ਜਾਣਗੇ ਨਾ ਅਤੇ ਵੀ ਬਾਕੀ ਤੁਸੀਂ ਨਿੰਬੂ ਪਾ ਦਿਓ ਅੱਧਾ ਕਿਲੋ ਅਤੇ ਬੰਦ ਗੋਭੀ ਪਾ ਦਿਓ ਅਤੇ ਇੱਕ ਪਾ ਦਿਓ ਤੁਸੀਂ ਖੀਰੇ ਟਮਾਟ ਟਮਾਟਰ ਪਾ ਦਿਓ ਜੀ ਦੋ ਕਿਲੋ ਅਤੇ ਬਸ ਆਹ ਸਬਜ਼ੀਆਂ ਪਾਉਣੀਆਂ ਜੀ ਸਾਰੀਆਂ ਅਤੇ ਰੇਟ ਦੱਸੋ ਜੀ ਕੀ ਕੀ ਲਾਊਗੇ ਮਟਰਾਂ ਦਾ ਕੀ ਰੇਟ ਆ ਸੋ ਰੁਪਏ ਕਿਲੋ ਜੀ ਅੱਛਾ ਡਿਸਕਾਊਂਟ ਕਰਕੇ ਲਾਇਓ ਜੀ ਅਸੀਂ ਤੁਹਾਡੇ ਪੁਰਾਣੇ ਗਾਹਕ ਹਾਂ ਠੀਕ ਹੈ ਜੀ ਅਤੇ ਪਨੀਰ ਦਾ ਜੀ ਠੀਕ ਹੈ ਜੀ ਚਲੋ ਤੁਸੀਂ ਬਸ ਸਾਰਾ ਬਿਲ ਬਣਾ ਕੇ ਜੀ ਮੈਨੂੰ ਵਟਸਐਪ ਕਰ ਦਿਓ ਸਾਰੀ ਸਬਜ਼ੀ ਦਾ ਬਿਲ ਬਣਾ ਕੇ ਵਟਸਐਪ ਕਰ ਦਿਓ ਸਾਨੂੰ ਅੱਜ ਸੱਤ ਤਰੀਕ ਹੈ ਨਾ ਜੀ ਸਾਨੂੰ ਨੌਂ ਤਰੀਕ ਨੂੰ ਸਾਰਾ ਸਮਾਨ ਚਾਹੀਦਾ ਹੈਗਾ ਅਤੇ ਤੁਸੀਂ ਜਦੋਂ ਹਾਂਜੀ ਹਾਂਜੀ ਪੈਸੇ ਗੂਗਲ ਪੇ ਕਰਾਂਗੇ ਮੈਨੂੰ ਸਾਰਾ ਸਮਾਨ ਦੀ ਡਿਟੇਲ ਬਣਾ ਕੇ ਵਟਸਐਪ ਕਰ ਦਿਓ ਤਾਂ ਤੁਹਾਨੂੰ ਗੂਗਲ ਪੇ ਕਰ ਦਾਂਗੇ ਅਤੇ ਨੌਂ ਤਰੀਕ ਨੂੰ ਸੁਬਾਹ ਸਾਡਾ ਕੋਈ ਲੜਕਾ ਆਊਗਾ ਇੱਥੋਂ ਸਮਾਨ ਚੁੱਕਣ ਵਾਸਤੇ ਤਾਂ ਤੁਹਾਨੂੰ ਮੈਂ ਕੋਲ ਕਰੂਗੀ ਤੁਸੀਂ ਉਹਨੂੰ ਸਮਾਨ ਚੁਕਾ ਦਿਓ ਸਾਰਾ ਐਡਰੈਸ ਲਿਖੋ ਜੀ ਸਾਡਾ ਕਲਗੀਧਰ ਗੁਰਦੁਆਰਾ ਜੀ ਹਾਂਜੀ ਕਲਗੀਧਰ ਗੁਰਦੁਆਰਾ ਵਾਰਡ ਨੰਬਰ ਨੌਂ 'ਚ ਹੈ ਜੀ ਸਾਡਾ ਘਰ ਧਰਮਸ਼ਾਲਾ ਦੇ ਸਾਹਮਣੇ ਹਾਂਜੀ ਜੇ ਤੁਸੀਂ ਪਹੁੰਚਾ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਹੀਂ ਅਸੀਂ ਫਿਰ ਕਿਸੇ ਲੜਕੇ ਨੂੰ ਭੇਜ ਦਾਂਗੇ ਤੁਹਾਡੇ ਕੋਲ ਅਤੇ ਤੁਸੀਂ ਸੁਬਾਹ ਸੁਬਾਹ ਜਲਦੀ ਭੇਜਾਂਗੇ ਤਾਂ ਸ਼ੋਪ ਖੋਲ ਲਿਓ ਅਤੇ ਕੋਲ ਰਿਸੀਵ ਕਰ ਲਿਓ ਸਾਡੀ ਹਾਂਜੀ ਹਾਂਜੀ ਕਿਉਂਕਿ ਫਿਰ ਅਸੀਂ ਸੁਬਾਹ ਜਲਦੀ ਲੈ ਕੇ ਜਾਵਾਂਗੇ ਫਿਰ ਹਲਵਾਈ ਰੈਡੀ ਕਰੂਗਾ ਸਾਡੀ ਦੁਪਹਿਰ ਤੱਕ ਸਾਰੇ ਰਿਸ਼ਤੇਦਾਰ ਆ ਜਾਣਗੇ ਅਸੀਂ ਚਾਰ ਵਜੇ ਕੇਕ ਕੱਟਣਾ ਬੇਟੇ ਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਰੇਟ ਹਿਸਾਬ ਨਾਲ ਲਾਇਓ ਜੀ ਚੰਗਾ ਜੀ ਡਿਸਕਾਊਂਟ ਕਰਕੇ ਅਤੇ ਹਾਂਜੀ ਠੀਕ ਹੈ ਜੀ ਕੁਛ ਫਰੂਟ ਪਾ ਦਿਓ ਜੀ ਬਾਅਦ 'ਚ ਕਿਲੋ ਦੋ ਕਿਲੋ ਐੱਪਲ ਪਾ ਦਿਆ ਜੋ ਠੀਕ ਹੈ ਓਕੇ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ